ਜਿਹੜਾ ਵਿਅਕਤੀ ਯੋਗਾ ਵਿੱਚ ਨਵਾਂ ਹੈ ਜਾਂ ਜਿਹੜਾ ਵਿਅਕਤੀ ਪਹਿਲੇ ਦਿਨ ਯੋਗਾ ਵਿੱਚ ਆ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਉਸ ਵਿਅਕਤੀ ਨੂੰ ਯੋਗਾ ਦੀ ਪਰਿਭਾਸ਼ਾ ਦੱਸਾਂਗਾ ਉਹਨੂੰ ਦੱਸਾਂਗਾ ਯੋਗਾ ਕੀ ਹੁੰਦਾ ਯੋਗਾ ਦੇ ਬੈਨੀਫਿਟਸ ਕੀ ਨੇ ਇਹਦੇ ਯੋਗਾ ਦੇ ਫਾਈਦੇ ਕੀ ਨੇ ਸਾਡੇ ਸਰੀਰ ਨੂੰ ਔਰ ਯੋਗਾ ਵਿੱਚ ਕਾਫੀ ਸਾਰੀਆਂ ਚੀਜ਼ਾਂ ਆ ਜਾਂਦੀਆਂ ਜਿਵੇਂ ਸੂਰਯ ਨਮਸਕਾਰ ਆ ਜਾਂਦੇ ਆ ਯੋਗ ਆਸਨ ਆ ਜਾਂਦੇ ਆ ਯੋਗ ਆ ਜਾਂਦੇ ਆ ਇਕੱਲੇ ਆਸਣ ਆ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਉਸ ਵਿਅਕਤੀ ਨੂੰ ਯੋਗਾ ਬਾਰੇ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਦੇਵਾਂਗਾ ਔਰ ਪਹਿਲੇ ਦਿਨ ਉਸ ਵਿਅਕਤੀ ਨੂੰ ਮੈਂ ਖੁਦ ਯੋਗਾ ਕਰਕੇ ਦੱਸਾਂਗਾ ਵੀ ਇਸ ਆਸਣ ਨੂੰ ਇਸ ਤਰੀਕੇ ਨਾਲ ਕੀਤਾ ਜਾਂਦਾ ਇਸ ਆਸਣ ਨੂੰ ਇਸ ਤਰੀਕੇ ਨਾਲ ਕੀਤਾ ਜਾਂਦਾ ਫਿਰ ਮੈਨੂੰ ਲੱਗਦਾ ਕਿ ਜਦੋਂ ਪਹਿਲੇ ਦਿਨ ਕੋਈ ਵੀ ਵਿਅਕਤੀ ਆ ਜਿਹੜਾ ਉਹ ਕਿਸੇ ਵੀ ਕੰਮ ਵਿੱਚ ਪਰਿਪੱਕ ਨਹੀਂ ਹੋ ਸਕਦਾ ਸੋ ਇਸ ਕਰਕੇ ਪਹਿਲੇ ਦਿਨ ਯੋਗਾ ਵਿੱਚ ਆਏ ਵਿਅਕਤੀ ਜਿਹੜਾ ਆ ਉਹ ਉਹਨੂੰ ਦੱਸਾਂਗੇ ਵੀ ਯੋਗਾ ਜਿਹੜਾ ਵਾ ਉਹ ਸਾਡੇ ਸਰੀਰ ਨੂੰ ਕਿਵੇਂ ਸਿਹਤਮੰਦ ਰੱਖਦਾ ਯੋਗਾ ਕਰਨ ਨਾਲ ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ ਉਹਨਾਂ ਦਾ ਵਿਕਾਸ ਹੁੰਦਾ ਸਾਡੇ ਸਰੀਰ ਦਾ ਵਿਕਾਸ ਹੁੰਦਾ ਯੋਗਾ ਦੇ ਨਾਲ ਸਾਨੂੰ ਸਾਡਾ ਸਰੀਰ ਜਿਹੜਾ ਉਹ ਸਵਸਥ ਰਹਿੰਦਾ ਔਰ ਜਿਵੇਂ ਕਿ ਅਸੀਂ ਜਾਣਦੇ ਹਾਂ ਵੀ ਕੁਝ ਸਾਲਾਂ ਤੋਂ ਇੱਕੀ ਜੂਨ ਨੂੰ ਯੋਗਾ ਡੇ ਮਨਾਇਆ ਜਾਂਦਾ ਜਿਹਦੇ ਵਿੱਚ ਵੱਖ ਵੱਖ ਸਕੂਲਾਂ ਕਾਲਜਾਂ ਸਰਕਾਰੀ ਦਫਤਰਾਂ ਹਰੇਕ ਬੰਦਾ ਜੋ ਕਿ ਯੋਗਾ ਕਰਦਾ ਔਰ ਇਸ ਦਾ ਮਕਸਦ ਸਿਰਫ ਇਹੋ ਹੀ ਆ ਕਿ ਸਾਡਾ ਜਿਹੜਾ ਸਮਾਜ ਹੈ ਸਾਡਾ ਜਿਹੜਾ ਦੇਸ਼ ਆ ਉਹ ਨਿਰੋਗ ਹੋ ਸਕੇ ਉਸ ਬੰਦੇ ਦੀ ਰੋਗਾਂ ਤੋਂ ਜਿਹੜੀ ਨਿਜਾਤ ਪਾਉਣ ਦੀ ਸ਼ਕਤੀ ਆ ਵੱਧ ਸਕੇ ਹਰੇਕ ਆਦਮੀ ਦੀ ਇਮਿਊਨਿਟੀ ਸਟਰੋਂਗ ਹੋ ਸਕੇ ਔਰ ਕੁੱਲ ਮਿਲਾ ਕੇ ਇਹੀ ਹੈ ਕਿ ਜਿਹੜਾ ਸਾਡਾ ਪੂਰਾ ਦੇਸ਼ ਹੈ ਉਹ ਰੋਗ ਮੁਕਤ ਹੋ ਸਕੇ ਜਿਸ ਕਰਕੇ ਯੋਗਾ ਦਾ ਜਿਹੜਾ ਵਾ ਉਹ ਅਭਿਆਸ ਇੱਕੀ ਜੂਨ ਨੂੰ ਹਰ ਵਾਰੀ ਕੀਤਾ ਜਾਂਦਾ ਧੰਨਵਾਦ